ਅਸੀਂ ਘਰ ਵਿੱਚ ਬਹੁਤ ਸਾਰਾ ਪੌਦੇ ਲਗਾਏ ਹੋਏ ਹਨ ਜਿੱਦਾਂ ਕਿ ਤੁਲਸੀ ਧਨੀਆ ਵਗੈਰਾ ਤੁਲਸੀ ਦੇ ਪੱਤੇ ਤਾਂ ਅਸੀਂ ਜਦੋਂ ਪਰਮਾਤਮਾ ਨੂੰ ਭੋਗ ਲਗਾਨੇ ਹਾਂ ਅਤੇ ਹਰ ਚੀਜ਼ ਵਿੱਚ ਤੁਲਸੀ ਦਾ ਪੱਤਾ ਜ਼ਰੂਰ ਰੱਖਦੇ ਹੈ ਤਾਂ ਕਿ ਉਹਨਾਂ ਨੂੰ ਭੋਗ ਲੱਗ ਸਕਦੇ ਅਤੇ ਦੂਜਾ ਅਸੀਂ ਧਨੀਆਂ ਵਗੈਰਾ ਵੀ ਗਮਲੇ ਦੇ ਵਿੱਚ ਲਗਾਇਆ ਹੋਇਆ ਤਾਂ ਕਿ ਧਨੀਆਂ ਵੀ ਸਾਨੂੰ ਫਾਇਦਾ ਕਰਦਾ ਹੈ ਅਤੇ ਐਲੋਵੇਰਾ ਜੈਲ ਦਾ ਵੀ ਅਸੀਂ ਪੌਦਾ ਲਗਾਇਆ ਤਾਂ ਕਿ ਇਹਦੇ ਨਾਲ ਮਾਸਕ ਵਗੈਰਾ ਵਧੀਆ ਬਣ ਜਾਂਦੇ ਆ ਅਤੇ ਹੋਰ ਵੇਲਾਂ ਵਗੈਰਾ ਵੀ ਅਸੀਂ ਲਗਾਏ ਜਿੱਦਾਂ ਮਨੀ ਪਲਾਂਟ ਦਾ ਬੂਟਾ ਲਗਾਉਣਾ ਹੁੰਦਾ ਮਨੀ ਪਲਾਂਟ ਕਈ ਲੋਕਾਂ ਦੀ ਇਹ ਸੋਚ ਹੈ ਕਿ ਮਨੀ ਪਲਾਂਟ ਲਗਾਉਣ ਦੇ ਨਾਲ ਘਰ ਵਿੱਚ ਬਰਕਤ ਪੈਂਦੀ ਹੈ ਅਤੇ ਹੋਰ ਵੀ ਬਹੁਤ ਸਾਰੇ ਫਾਇਦੇ ਹੁੰਦੇ ਆ ਵੇਲਾਂ ਲਗਾਉਣ ਦੇ ਜੇ ਅਸੀਂ ਵੇਲ ਘਰ ਲਗਾਈਏ ਅਤੇ ਮਤਲਬ ਕਿ ਕਈ ਪੌਦੇ ਹੁੰਦੇ ਕਈ ਸਬਜ਼ੀਆਂ ਵੇਲਾਂ ਤੋਂ ਹੀ ਆ ਜਾਂਦੀਆਂ ਸਾਨੂੰ ਕਿ ਜਿੱਦਾਂ ਮਤਲਬ ਕਿ ਹੋਰ ਕਈ ਸਬਜ਼ੀਆਂ ਹੋ ਜਾਂਦੀਆਂ ਖਾਣੀਆਂ ਹੀ ਪੈਂਦੀਆਂ ਸਾਨੂੰ ਅਤੇ ਜਿੱਦਾਂ ਧਨੀਏ ਦਾ ਬੂਟਾ ਹੋ ਗਿਆ ਮਤਲਬ ਕਿ ਹੋਰ ਪੁਦੀਨੇ ਦਾ ਬੂਟਾ ਹੋ ਗਿਆ ਪੁਦੀਨੇ ਦੀ ਚਟਨੀ ਸਿਹਤ ਵਾਸਤੇ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਇਸ ਕਰਕੇ ਪੁਦੀਨਾ ਅਸੀਂ ਘਰ ਲਗਾਈ ਦਾ ਤਾਂ ਕਿ ਲੋੜ ਪੈਣ 'ਤੇ ਅਸੀਂ ਪੁਦੀਨੇ ਦੀ ਚਟਨੀ ਵੀ ਦਾ ਸੇਵਨ ਵੀ ਕਰ ਸਕੀਏ ਹੋਰ ਸਾਨੂੰ ਗਾਰਡਨਿੰਗ ਦਾ ਬਹੁਤ ਵਧੀਆ ਸ਼ੌਂਕ ਹੈ ਇਹਦੇ ਵਿੱਚ ਵਧੀਆ ਖਾਦ ਪਾ ਕੇ ਰੱਖੀਦੀ ਹੈ ਤਾਂ ਕਿ ਬੂਟੇ ਖਰਾਬ ਨਾ ਹੋਣ ਅਤੇ ਰੋਜ਼ ਸ਼ਾਮ ਨੂੰ ਅਸੀਂ ਪਾਣੀ ਵੀ ਇਹਨਾਂ ਨੂੰ ਦਿੰਦੇ ਹਾਂ ਤਾਂ ਕਿ ਵਧੀਆ ਮਤਲਬ ਕਿ ਸਾਨੂੰ ਪੱਤੇ ਵਗੈਰਾ ਆਉਣ 'ਤੇ ਤੁਲਸੀ ਦਾ ਬੂਟਾ ਰੱਖਣਾ ਤਾਂ ਘਰ ਵਿੱਚ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਅਤੇ ਉੱਤੋਂ ਜਿਹੜਾ ਐਲੋਵੇਰਾ ਜੈੱਲ ਹੈਗੀ ਹੈ ਉਹਦਾ ਵੀ ਮਾਸਕ ਵਗੈਰਾ ਬਹੁਤ ਵਧੀਆ ਬਣ ਸਕਦਾ ਹੋਰ ਕਈ ਪੌਦੇ ਵੀ ਹੈਗੇ ਆ ਜੋ ਸਾਡੇ ਜਿਹਨਾਂ ਦੇ ਵਿੱਚ ਜਿਹਨਾਂ ਤੋਂ ਦਵਾਈਆਂ ਵੀ ਬਣਦੀਆਂ ਅਤੇ ਉਹ ਸਾਡੀ ਸਿਹਤ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਅਤੇ ਇਸ ਕਰਕੇ ਸਾਨੂੰ ਗਾਰਡਨਿੰਗ ਦਾ ਬਹੁਤ ਜ਼ਿਆਦਾ ਕਰਨਾ ਪੈਂਦਾ ਅਤੇ ਇਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਜੇ ਇਹਨਾਂ ਦੀ ਅਸੀਂ ਸਹੀ ਦੇਖਭਾਲ ਕ ਨਹੀਂ ਕਰਦੇ ਤਾਂ ਬੂਟੇ ਸੜ ਸੁੱਕ ਜਾਣਗੇ